ਭੰਗੜਾ ਦਿਲੋਂ ਕਰਿਆ ਜਾਂਦਾ ਹੈ ਭੰਗੜੇ ਲਈ ਕਿਸੇ ਇੱਕ ਗੀਤ ਦੀ ਜ਼ਰੂਰਤ ਨਹੀਂ ਹਨ ਪਰ ਮੈਨੂੰ ਲੱਗਦਾ ਹੈ ਜੇਕਰ ਭੰਗੜਾ ਪਾਉਣਾ ਹੈ ਤਾਂ ਪੰਜਾਬੀ ਗੀਤ ਤੋਂ ਵ ਸੋਹਣਾ ਗੀਤ ਕੋਈ ਨਹੀਂ ਹੋ ਸਕਦਾ ਅੱਜ ਕੱਲ੍ਹ ਬਥੇਰੇ ਗੀਤ ਚੱਲੇ ਹਨ ਪਰ ਜਿਹੜੇ ਪੁਰਾਣੇ ਗਾਣਿਆਂ ਹੈ ਉਹਨਾਂ ਦੀ ਕੋਈ ਰੀਸ ਨਹੀਂ ਪੁਰਾਣੇ ਗਾਣਿਆਂ ਵਿੱਚ ਹੀ ਜੋ ਮਜ਼ਾ ਆਉਂਦਾ ਹੈ ਭੰਗੜੇ ਦਾ ਉਹ ਕਿਸੇ ਹੋਰ ਮਜ਼ੇ ਵਿੱ ਭੰਗ ਉਹ ਕਿ ਕਿਸੇ ਗੀਤ ਵਿੱਚ ਨਹੀਂ ਆ ਸਕਦਾ ਮੇਰਾ ਮਨ ਪਸੰਦ ਗੀਤ ਬਿੰਦਰਖੀਏ ਦੇ ਹਨ ਜੋ ਕਿ ਪੁਰਾਣੇ ਗਾਣੇ ਹਨ ਬਹੁਤ ਸੋਹਣੇ ਸੋਹਣੇ ਗਾਣੇ ਹਨ ਜਿਵੇਂ ਕਿ ਬੱਬੂ ਮਾਨ ਦੇ ਗਾਣੇ ਹੋ ਗਏ ਕਰਨ ਔਜਲੇ ਦੇ ਗਾਣੇ ਹੋ ਗਏ ਇਹਨਾਂ 'ਤੇ ਬਹੁਤ ਸੋਹਣਾ ਭੰਗੜਾ ਪੈ ਸਕਦਾ ਹੈ ਅੱਜ ਕੱਲ੍ਹ ਇੱਕ ਗਾਣਾ ਬਹੁਤ ਚੱਲ ਰਿਹਾ ਹੈ ਚੁੰਨੀ ਮੇਰੀ ਰੰਗ ਦੇ ਲਲਾਰੀਆ ਇਹ ਗਾਣੇ 'ਤੇ ਬਹੁਤ ਭੰਗੜੇ ਪੈ ਰਹੇ ਹਨ ਇਸ ਲਈ ਮੈਨੂੰ ਵੀ ਦਿਲ ਤੋਂ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਮੈਂ ਇਸ ਗਾਣੇ 'ਤੇ ਭੰਗੜਾ ਪਾਉਂਦੀ ਹਾਂ ਇਸ ਤੋਂ ਇਲਾਵਾ ਹੋਰ ਬਹੁਤ ਗਾਣੇ ਹਨ ਬਟ ਬਹੁਤ ਬੋਲੀਆਂ ਹਨ ਜਿਹੜੀਆਂ ਕਿ ਪਾਈ ਜਾਂਦੀਆਂ ਹਨ ਸਿੱਧੂ ਮੂਸੇਵਾਲੇ ਦੇ ਕਿੰਨੇ ਗਾਣੇ ਹਨ ਜਿਹਨਾਂ ਉੱਤੇ ਭੰਗੜਾ ਪਾਇਆ ਜਾ ਸਕਦਾ ਹੈ ਕਰਨ ਔਜਲਾ ਦੇ ਗਾਣੇ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਇਹ ਗਾਣਾ ਮੈਨੂੰ ਬਹੁਤ ਪਸੰਦ ਹੈ ਅਤੇ ਮੈਂ ਇਸ 'ਤੇ ਬਹੁਤ ਨੱਚਦੀ ਹਾਂ ਤੂੰ ਕਾਹਦੀ ਪੰਜਾਬਣ ਜੇ ਤੈਨੂੰ ਨੱਚਣਾ ਨੀ ਆਉਂਦਾ ਇਹ ਕੁਛ ਅਜਿਹੇ ਗਾਣੇ ਹਨ ਜੋ ਸਾਡੀ ਵਿਰਸਾ ਵਿਰਾਸਤ ਨੂੰ ਦਰਸ਼ਾਉਂਦੇ ਹਨ ਖ਼ਾਸ ਕਰਕੇ ਪੰਜਾਬੀ ਵਿਰਾਸਤ ਨੂੰ ਗਿੱਧੇ ਦੇ ਕਈ ਗਾਣੇ ਹਨ ਕਈ ਬੋਲ ਹਨ ਕਈ ਬੋਲੀਆਂ ਹਨ ਜੋ ਕਿ ਪਾਈਆਂ ਜਾਂਦੀਆਂ ਹਨ ਇਸ ਲਈ ਮੈਨੂੰ ਲੱਗਦਾ ਹੈ ਭੰਗੜਾ ਪਾਉਣ ਲਈ ਪੰਜਾਬੀ ਗੀਤ ਤੋਂ ਸੋਹਣੇ ਕੋਈ ਗੀਤ ਹੋ ਨਹੀਂ ਸਕਦੇ ਤੂੰ ਕਾਹਦੀ ਪੰਜਾਬਣ ਜੇ ਤੈਨੂੰ ਨੱਚਣਾ ਨੀ ਆਉਂਦਾ ਇਹ ਗਾਣਾ ਵੀ ਬਹੁਤ ਸੋਹਣਾ ਗਾਣਾ ਹੈ ਜਿਹਦੇ ਉੱਤੇ ਰੱਜ ਕੇ ਸੋਹਣਾ ਜਿਹਾ ਭੰਗੜਾ ਪਾਇਆ ਜਾ ਸਕਦਾ